ਪੰਜ ਬਈ ਉੱਨੀ ਸੌ ਨੱਬੇ ਛੇ ਅਪ੍ਰੈਲ ਦੋ ਹਜ਼ਾਰ ਛੇ ਅਠਾਰ੍ਹਾਂ ਦਸੰਬਰ ਉੱਨੀ ਸੌ ਇਕਾਨਵੇਂ ਸੱਤ ਮਾਰਚ ਦੋ ਹਜ਼ਾਰ ਸੱਤ ਚਾਰ ਅਗਸਤ ਦੋ ਹਜ਼ਾਰ ਚਾਰ